ਲਾਈਟ ਪ੍ਰਦੂਸ਼ਣ ਨੇ ਵਿੱਚ ਸਾਡੇ ਆਲੇ ਦੁਆਲੇ ਫੈਕਟਰੀਆਂ ਹੋਣ ਕਰਕੇ ਪ੍ਰਦੂਸ਼ਣ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਅਸੀਂ ਕਈ ਬਿਮਾਰੀਆਂ ਦੀ ਚਪੇਟ ਵਿੱਚ ਵੀ ਆ ਰਹੇ ਹਾਂ ਅਤੇ ਅਸੀਂ ਸਾਫ ਅਸਮਾਨ ਵੀ ਨਹੀਂ ਦੇਖ ਰਹੇ ਇਸ ਕਰਕੇ ਮੈਨੂੰ ਮੇਰਾ ਜਿਹੜਾ ਘਰ ਹੋਇਆ ਉਹ ਇਲਾਕਾ ਹੈ ਜਿਹੜਾ ਉਹ ਛੋਟਾ ਹੈ ਸ਼ਹਿਰ ਹੈ ਕਸਬਾ ਹੈ ਅਤੇ ਉੱਥੇ ਕ ਪ੍ਰਦੂਸ਼ਣ ਦੀ ਕ ਕਮੀ ਹੈ ਜ਼ਿਆਦਾ ਪ੍ਰਦੂਸ਼ਣ ਨਹੀਂ ਹੈ ਅਤੇ ਫੈਕਟਰੀਆਂ ਵੀ ਘੱਟ ਹੈ ਹਰਾ ਭਰਾ ਰਹਿਣ ਹੋਣ ਕਰਕੇ ਮੈਂ ਇਹਨਾਂ ਦੀ ਸਾਰਿਆਂ ਨੂੰ ਕੋਠੇ 'ਤੇ ਜਾ ਕੇ ਹੀ ਛੱਤ 'ਤੇ ਹੀ ਦੇਖ ਲੈਂਦਾ ਹਾਂ ਅਤੇ ਇਹਨਾਂ ਨੂੰ ਦੇਖ ਕੇ ਮ ਆਨੰਦ ਮਾਣ ਲੈਂਦੇ ਹਾਂ